ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਅੱਜ ਦੇ ਤਕਨੀਕੀ ਯੁੱਗ ਵਿੱਚ ਬਹੁਤ ਸਾਰੀਆਂ ਨਵੀਆਂ ਨਵੀਆਂ ਟੈਕਨੋਲੋਜੀ ਆ ਰਹੀਆਂ ਹਨ ਅੱਜ ਕੱਲ੍ਹ ਔਨਲਾਈਨ ਪਲੈਟਫੋਮ ਵੀ ਬਹੁਤ ਆ ਚੁੱਕੇ ਹਨ ਜਿਵੇਂ ਕਿ ਪਹਿਲਾਂ ਲੋਕ ਬਜਾਰੋਂ ਖਰੀਦਾਰੀ ਕਰਦੇ ਸੀਗੇ ਅੱਜ ਕੱਲ੍ਹ ਔਨਲਾਈਨ ਐਪਸ ਦੁਆਰਾ ਹੀ ਇਹ ਖਰੀਦਾਰੀ ਹੋ ਜਾਂਦੀ ਹੈ ਮੇਰੀ ਇੱਕ ਸਹੇਲੀ ਹੈ ਜੋ ਕਿ ਔਨਲਾਈਨ ਸ਼ੋਪਿੰਗ ਕਰਦੀ ਰਹਿੰਦੀ ਹੈ ਉਸ ਨੇ ਮੈਨੂੰ ਵੀ ਕਿਹਾ ਕਿ ਤੂੰ ਔਨਲਾਈਨ ਸ਼ੋਪਿੰਗ ਕਰਕੇ ਦੇਖਿਆ ਕਰ ਇੱਥੇ ਚੀਜ਼ਾਂ ਬਹੁਤ ਹੀ ਸਸਤੀਆਂ ਮਿਲਦੀਆਂ ਹਨ ਪਰ ਮੈਂ ਹਮੇਸ਼ਾਂ ਇਸ ਚੀਜ਼ ਤੋਂ ਡਰਦੀ ਹਾਂ ਕਿ ਕਿਤੇ ਕੋਈ ਚੀਜ਼ ਖ਼ਰਾਬ ਨਾ ਆ ਜਾਵੇ ਜਾਂ ਫਿਰ ਕੋਈ ਫਰੋਡ ਨਾ ਹੋ ਜਾਵੇ ਜਾਂ ਕੋਈ ਮੇਰੇ ਪੈਸੇ ਨਾ ਮਾਰੇ ਜਾਣ ਫਿਰ ਮੈਂ ਕੁਛ ਸਮੇਂ ਬਾਅਦ ਉਹਦੀ ਗੱਲ ਸੋਚੀ ਮੈਂ ਕਿਹਾ ਕੇ ਚਲੋ ਹੈ ਨਾ ਟਰਾਈ ਕਰਕੇ ਦੇਖਦੇ ਹਾਂ ਮੇਰੀ ਭੈਣ ਦਾ ਜਨਮਦਿਨ ਆ ਰਿਆ ਸੀ ਅਤੇ ਮੈਂ ਸੋਚਿਆ ਮੈਂ ਆਪਣੀ ਭੈਣ ਨੂੰ ਜਨਮਦਿਨ 'ਚ ਇਹ ਹੈਡਫੋਨ ਗਿਫ਼ਟ ਕਰਾਂ ਫਿਰ ਮੈਂ ਔਨਲਾਈਨ ਐਪ ਡਾਊਨਲੋਡ ਕੀਤੀ ਤਾਂ ਮੈਂ ਉੱਥੇ ਦੇਖਿਆ ਉੱਥੇ ਕੰਪਨੀ ਵਾਲਿਆਂ ਨੇ ਬਹੁਤ ਚੰਗਾ ਚੰਗਾ ਰੀਵਿਊ ਲਿਖਿਆ ਹੋਇਆ ਸੀ ਕਿ ਇੰਨੇ ਘੱਟ ਪ੍ਰਾਈਜ਼ 'ਚ ਇਹ ਮਿਲਦੇ ਆ ਇਨ੍ਹਾਂ ਦੀ ਕੁਆਲਟੀ ਬਹੁਤ ਵਧੀਆ ਹੁੰਦੀ ਹੈ ਬਹੁਤ ਕੁਛ ਲਿਖਿਆ ਸੀਗਾ ਅਤੇ ਉਨ੍ਹਾਂ ਨੇ ਡਿਲੀਵਰੀ ਟਾਈਮ ਵੀ ਦੱਸਿਆ ਸੀ ਕਿ ਤਿੰਨ ਦਿਨ ਪਹਿਲਾਂ ਤੁਹਾਨੂੰ ਇਹ ਮਿਲ ਜਾਣਗੇ ਮੇਰਾ ਇਸ ਸਭ ਦੇ ਪ੍ਰਤੀ ਇੰਨਾ ਬੁਰਾ ਅਨੁਭਵ ਰਿਹਾ ਕਿ ਜਿਹੜੀ ਡਿਲਵਰੀ ਸੀ ਉਹ ਵੀ ਤਿੰਨ ਚਾਰ ਦਿਨ ਬਾਅਦ ਹੋਈ ਅਤੇ ਜਿਹੜਾ ਮੇਰੀ ਭੈਣ ਦਾ ਦਿਨ ਖ਼ਰਾਬ ਹੋਇਆ ਉਹ ਸੋ ਹੋਇਆ ਮੇਰਾ ਮਨ ਵੀ ਬਹੁਤ ਉਦਾਸ ਹੋਇਆ ਕਿ ਮੈਂ ਆਪਣੀ ਭੈਣ ਨੂੰ ਕੋਈ ਤੋਹਫ਼ਾ ਨਹੀਂ ਦੇ ਪਾਈ ਤਿੰਨ ਚਾਰ ਦਿਨ ਬਾਅ ਦ ਇਨ ਦੀ ਡਿਲਿਵਰੀ ਹੋਈ ਅਤੇ ਫਿਰ ਜਦੋਂ ਆਏ ਅਸੀਂ ਇਨ੍ਹਾਂ ਦੀ ਇਹ ਚੈੱਕ ਕੀਤੇ ਇਨ੍ਹਾਂ ਦੀ ਕੁਆਲਟੀ ਵੀ ਬਹੁਤ ਬੁਰੀ ਸੀਗੀ ਕੋਈ ਵਧੀਆ ਕੁਆਲਟੀ ਨਹੀਂ ਸੀ ਇਨ੍ਹਾਂ ਦੀ ਜੋ ਕੁਛ ਕੰਪਨੀ ਵਾਲਿਆਂ ਨੇ ਰੀਵਿਊ ਲਿਖਿਆ ਸੀਗਾ ਸਭ ਝੂਠ ਸੀਗਾ ਫਿਰ ਜਦੋਂ ਮੈਂ ਫੋਨ ਕਰਕੇ ਇਨ੍ਹਾਂਦੀ ਸ਼ਿਕਾਇਤ ਕੀਤੀ ਤਾਂ ਇਨ੍ਹਾਂ ਨੇ ਕੋਈ ਵੀ ਰਿਸਪੋਂਸ ਨਹੀਂ ਕੀਤਾ ਅੱਗੋਂ ਇਨ੍ਹਾਂ ਨੇ ਗੱਲ ਇਗਨੋਰ ਕਰਤੀ ਫਿਰ ਜਦੋਂ ਮੈਂ ਇਨ੍ਹਾਂ ਦੀ ਇਹ ਮਤਲਬ ਇਨ੍ਹਾਂ ਦੇ ਵਿਊ ਮੈਂ ਇਨ੍ਹਾਂ ਨੂੰ ਬੈਡ ਰੀਵਿਊ ਦੇਣ ਲੱਗਗੇ ਸੀਗੇ ਇਨ੍ਹਾਂ ਦੀ ਕੰਪਨੀ ਵਾਲਿਆਂ ਨੂੰ ਇਹ ਤੁਹਾਡਾ ਸਮਾਨ ਇੱਦਾਂ ਹੀ ਆਇਆ ਤੁਹਾਡੀ ਕੋਈ ਕੁਆਲਟੀ ਵਧੀਆ ਨਹੀਂ ਹੈਗੀ ਬਿਲਕੁਲ ਬੇਕਾਰ ਕੁਆਲਟੀ ਸੀਗੀ ਉਨ੍ਹਾਂ ਦੀ ਤਾਂ ਫਿਰ ਇਨ੍ਹਾਂ ਨੂੰ ਥੋੜ੍ਹੀ ਸ਼ਰਮ ਪਈ ਫਿਰ ਇਨ੍ਹਾਂ ਨੇ ਇਨ੍ਹਾਂ ਦਾ ਕੋਈ ਮੈਸਿਜ ਆਇਆ ਮੇਰੇ ਕੋਲ ਮੁਆਫੀ ਮੁਆਫੀ ਮੰਗਣ ਲੱਗੇ ਕਿ ਮੈਮ ਇੱਦਾਂ ਇੱਦਾਂ ਸੋਰੀ ਫਿਰ ਹੋਰ ਲੋਕਾਂ ਨਾਲ ਵੀ ਜਿਨ੍ਹਾਂ ਨਾਲ ਫਰੋਡ ਹੋਇਆ ਸੀਗਾ ਉਨ੍ਹਾਂ ਨੂੰ ਉਨ੍ਹਾਂ ਦੇ ਵੀ ਪੈਸੇ ਵਾਪਿਸ ਦਿੱਤੇ ਮੇਰੇ ਵੀ ਵਾਪਿਸ ਦਿੱਤੇ ਗਏ ਪਰ ਮੈਨੂੰ ਇਸ ਚੀਜ਼ ਦਾ ਦੁੱਖ ਸੀ ਕਿ ਉਸ ਦਿਨ ਮੇਰੀ ਭੈਣ ਦਾ ਦਿਨ ਵੀ ਖ਼ਰਾਬ ਹੋਇਆ ਨਾਲੇ ਮੈਨੂੰ ਮੇਰਾ ਮੈਂ ਵੀ ਇੰਨੇ ਤਨਾਵ 'ਚ ਰਹੀ ਇੰਨੇ ਦਿਨ ਅਤੇ ਬਹੁਤ ਬੁਰਾ ਸੀਗਾ ਉਹ ਅਨੁਭਵ ਮੇਰਾ ਧੰਨਵਾਦ